ਸਤਿ ਸ਼੍ਰੀ ਅਕਾਲ ਸਰ ਉਬਰ ਤੋਂ ਗੱਲ ਕਰ ਰਹੇ ਹੋ ਜੀ ਮੈਂ ਪੰਦਰਾਂ ਮਿੰਟ ਪਹਿਲਾਂ ਤੁਹਾਡੀ ਕੈਬ ਬੁੱਕ ਕੀਤੀ ਸੀ ਜਿਸ ਦੇ ਡਰਾਇਵਰ ਦਾ ਨਾਮ ਗੁਰਵਿੰਦਰ ਸਿੰਘ ਸੀ ਜਿਸਨੇ ਕਿ ਪਹਿਲਾਂ ਮੇਰੀ ਕਾਲ ਚੁੱਕੀ ਅਤੇ ਕਿਹਾ ਮੈਂ ਪੰਦਰਾਂ ਮਿੰਟ ਵਿਚ ਆ ਰਿਹਾ ਹਾਂ ਪਰ ਹਾਲੇ ਤੱਕ ਉਹ ਨਹੀਂ ਆਇਆ ਮੈਂ ਬਹੁਤ ਹੀ ਜ਼ਰੂਰੀ ਕੰਮ ਲਈ ਚੰਡੀਗੜ੍ਹ ਜਾਣਾ ਹੈ ਅਤੇ ਹੁਣ ਮੈਂ ਸਨੀ ਇੰਨਕਲੇਵ ਲਾਈਟਾਂ 'ਤੇ ਖੜ੍ਹਾ ਹਾਂ ਜੇਕਰ ਉਹ ਡਰਾਈਵਰ ਮੇਰੇ ਕੋਲ ਪੰਜ ਜਾਂ ਦਸ ਮਿੰਟ ਵਿੱਚ ਪਹੁੰਚ ਰਿਹਾ ਹੈ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਕੋਈ ਹੋਰ ਡਰਾਈਵਰ ਉਪਲਬਧ ਕਰਵਾਇਆ ਜਾਵੇ ਕਿਉਂਕਿ ਗੁਰਵਿੰਦਰ ਸਿੰਘ ਕੈਬ ਡਰਾਈਵਰ ਮੇਰਾ ਫੋਨ ਨਹੀਂ ਚੁੱਕ ਰਿਹਾ ਅਤੇ ਮੈਂ ਰੋਡ 'ਤੇ ਖੜ੍ਹਾ ਬਹੁਤ ਹੀ ਪ੍ਰੇਸ਼ਾਨ ਹੋ ਰਿਹਾ ਹਾਂ ਅਤੇ ਜੇਕਰ ਮੈਂ ਲੇਟ ਹੋ ਗਿਆ ਤਾਂ ਮੇਰੀ ਨੌਕਰੀ ਵੀ ਜਾ ਸਕਦੀ ਹੈ ਕਿਰਪਾ ਕਰਕੇ ਮੇਰੀ ਸਮੱਸਿਆ ਦਾ ਹੱਲ ਕੀਤਾ ਜਾਵੇ ਧੰਨਵਾਦ ਜੀ